ਉਂਝ ਤਾਂ ਭਾਰ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ ਬਟ ਅੱਜ ਮੈਂ ਕੁਝ ਤਰੀਕਿਆਂ ਬਾਰੇ ਦੱਸਣ ਜਾ ਰਹੀ ਹਾਂ ਪਹਿਲਾ ਤਰੀਕਾ ਇਹ ਹੈ ਕਿ ਜੇਕਰ ਬੰਦਾ ਕੋਈ ਵੀ ਇਨਸਾਨ ਆਪਣਾ ਭਾਰ ਘਟਾਉਣਾ ਚ ਵਧਾਉਣਾ ਚਾਹੁੰਦਾ ਹੈ ਚਾਹੇ ਉਹ ਲੇਡੀ ਹੈ ਚਾਹੇ ਉਹ ਜੈਨਟਸ ਹੈ ਉਹ ਜਿੰਨਾਂ ਜੰਕ ਫੂਡ ਹੋ ਸਕੇ ਉਹ ਖਾ ਸਕਦੇ ਹਨ ਕਿਉਂਕਿ ਜੰਕ ਫੂਡ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਅਸੀਂ ਜੇ ਬ੍ਰੈੱਡ ਨੂੰ ਲਈਏ ਤਾਂ ਬ੍ਰੈੱਡ ਦੇ ਵਿੱਚ ਬਹੁਤ ਜ਼ਿਆਦਾ ਫੈਟ ਹੁੰਦੀ ਆ ਉਹ ਫੈਟ ਕੀ ਕਰਦੀ ਆ ਸਾਡੇ ਅੰਦਰੂਨੀ ਫੈਟ ਨੂੰ ਵਧਾਉਂਦੀ ਹੈ ਅਸੀਂ ਫ਼ਲ ਫਰੂਟ ਖਾ ਸਕਦੇ ਹਾਂ ਫ਼ਲ ਫ਼ਲ ਫਰੂਟ ਖਾ ਸਕਦੇ ਹਾਂ ਦੂਜਾ ਤਰੀਕਾ ਉਹਦੇ ਵਿੱਚ ਬਹੁਤ ਜ਼ਿਆਦਾ ਫਾਈਵਰ ਹੁੰਦੀ ਉਹ ਸਾਡੀ ਫੈਟ ਨੂੰ ਵਧਾਉਂਦੀ ਹੈ ਜੇ ਅਸੀਂ ਦੁ ਮੱਝ ਦਾ ਜਿਹੜਾ ਦੁੱਧ ਹੈ ਮੱਝ ਦੇ ਦੁੱਧ ਦਾ ਘਿਓ ਖਾਈਏ ਲੱਸੀ ਪੀਏ ਉਹ ਵਾਲੇ ਉਹ ਤਾਂ ਫਿੱਟ ਤਾਂ ਰੱਖਦੀਆਂ ਬਟ ਉਹਦੇ ਨਾਲ਼ ਸਾਡੀ ਕੀ ਆ ਫੈਟ ਵੀ ਮੋਟਾਪਾ ਵੀ ਜਿਹੜਾ ਆ ਉਹ ਵੱਧਦਾ ਆ